ਆਰਟੀਫਿਸ਼ਲ ਇੰਨਟੈਲੀਜੈਂਸ ਅੱਜ ਦੇ ਸਮੇਂ ਦੀ ਲੋੜ ਹੈ ਸੰਕੁਚਿਤ ਸਮੇਂ ਦੇ ਵਿੱਚ ਸਾਰੇ ਕੰਮ ਕਰਨ ਲਈ ਆਰਟੀਫਿਸ਼ਲ ਇੰਨਟੈਲੀਜੈਂਸ ਬਹੁਤ ਮਹੱਤਵਪੂਰਨ ਹੈ ਪਰ ਇਹ ਮਨੁੱਖ ਦੀਆਂ ਭਾਵਨਾਵਾਂ ਨੂੰ ਵਿਅਕਤ ਕਰ ਦੇਵੇ ਅਜਿਹਾ ਨਹੀਂ ਹੈ ਇਸ ਕਰਕੇ ਇਹਦੇ ਨਾਲ ਮਨੁੱਖ ਆਪਣੀ ਰਚਨਾਤਮਕਤਾ ਖਤਮ ਕਰ ਰਿਹਾ ਹੈ ਉਹਦੇ ਵਿੱਚ ਰਚਨਾਤਮਕਤਾ ਆਪਣੀ ਰਚਨਾਤਮਕਤਾ ਖਤਮ ਹੋ ਰਹੀ